ਯੋਗ ਅਭਿਆਸ ਯੋਗਾ ਕਰਨ ਤੋਂ ਬਾਅਦ ਸਾਡੇ ਸਰੀਰ ਨੂੰ ਮਾਨਸਿਕ ਅਤੇ ਸਰੀਰਕ ਜੋ ਸ਼ਾਂਤੀ ਮਿਲਦੀ ਹੈ ਸਾਡੇ ਸਰੀਰ ਦੇ ਸਾਰੇ ਹੀ ਅੰਗ ਜਿਹੜੇ ਤਰੋ ਤਾਜ਼ਾ ਮਹਿਸੂਸ ਕਰਦੇ ਆ ਜੇਕਰ ਅਸੀਂ ਸਵੇਰ ਦੀ ਸੈਰ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਸਵੇਰ ਦਾ ਕੁਦਰਤੀ ਨਜ਼ਾਰਾ ਅਤੇ ਪੰਛੀਆਂ ਦੀ ਚਹਿਲ ਪਹਿਲ ਦੇਖਣ ਨੂੰ ਮਿਲਦੀ ਹੈ ਜੋ ਕਿ ਸਾਡੇ ਮਨ ਨੂੰ ਬਹੁਤ ਹੀ ਚੰਗਾ ਪ੍ਰਭਾਵ ਦਿੰਦੀ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਵਿੱਚ ਜੇਕਰ ਅਸੀਂ ਰੋਜ਼ਾਨਾ ਆਪਣੇ ਯੋਗ ਨੂੰ ਇੱਕ ਹਿੱਸਾ ਬਣਾ ਲੈਂਦੇ ਹਾਂ ਜਾਂ ਅਸੀਂ ਸਵੇਰੇ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਆਪਣਾ ਯੋਗਾ ਜਾਂ ਕਸਰਤ ਕਰਦੇ ਹਾਂ ਤਾਂ ਇਹ ਸਾਡੀ ਪਾਚਨ ਪ੍ਰਣਾਲੀ ਨੂੰ ਵੀ ਬਹੁਤ ਤੰਦਰੁਸਤ ਰੱਖਦੀ ਹੈ ਅਤੇ ਸਾਨੂੰ ਖਾਧਾ ਪੀਤਾ ਜਿਹੜਾ ਉਹ ਈਜਲੀ ਪਚ ਜਾਂਦਾ ਜਿਸ ਦੇ ਕਾਰਨ ਅਸੀਂ ਕਈ ਰੋਗਾਂ ਤੋਂ ਰਹਿਤ ਰਹਿ ਜਾਂਦੇ ਹਾਂ ਯੋਗ ਅਭਿਆਸ ਕਰਨ ਦੇ ਨਾਲ ਸਾਨੂੰ ਮੋਟਾਪਾ ਵੀ ਨਹੀਂ ਆਉਂਦਾ ਸਾਡੇ ਸਰੀਰ ਵਿੱਚ ਚੁਸਤੀ ਫੁਰਤੀ ਰਹਿੰਦੀ ਹੈ ਅਤੇ ਦਿਮਾਗ ਵੀ ਸਾਡਾ ਤਰੋ ਤਾਜ਼ਾ ਰਹਿੰਦਾ ਹੈ ਸਵੇਰ ਦੀ ਸੈਰ ਦੇ ਬਹੁਤ ਲਾਭ ਹਨ ਜਿਵੇਂ ਕਿ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਹੱਡੀਆਂ ਦੀ ਮਜਬੂਤੀ ਮਿਲਦੀ ਹੈ ਸਵੇਰ ਦੀ ਜਿਹੜੀ ਤਾਜ਼ੀ ਧੁੱਪ ਸਰਦੀਆਂ ਦੇ ਵਿੱਚੋਂ ਵਿਟਾਮਿਨ ਡੀ ਸਾਨੂੰ ਦਿੰਦੀ ਹੈ ਜਿਸ ਕਾਰਨ ਹੱਡੀਆਂ ਵਿੱਚ ਮਜਬੂਤੀ ਆਉਂਦੀ ਹੈ ਸਵੇਰ ਦੀ ਸੈਰ ਹਰੇਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਉਮਰ ਵਧਦੀ ਦੇ ਨਾਲ ਨਾਲ ਸਾਨੂੰ ਖਾਣ ਪੀਣ ਦੇ ਨਾਲ ਨਾਲ ਜੋ ਸਾਡੇ ਖਾਣ ਪੀਣ ਦੀ ਰੂਟੀਨ ਹੈ ਉਸ ਤੋਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਐਸੀਡਿਟੀ ਵਗੈਰਾ ਮੋਟਾਪਾ ਵਗੈਰਾ ਜਾਂ ਹੋਰ ਯੂਰਿਕ ਐਸਿਡ ਕਈ ਬਿਮਾਰੀਆਂ ਜਿਹੜੀਆਂ ਅੱਜ ਤੱਕ ਕਈਆਂ ਦੇ ਆਪਾਂ ਨਾਮ ਨਹੀਂ ਸੁਣੇ ਉਹ ਵੀ ਲੱਗ ਜਾਂਦੀਆਂ ਅਤੇ ਸਵੇਰ ਦੀ ਸੈਰ ਜਿਹੜੀ ਹੈ ਸਭ ਤੋਂ ਉੱਤਮ ਜੋ ਇੱਕ ਚੀਜ਼ ਹੈਗੀ ਹੈ ਉੱਤਮ ਕਿ ਇਸ ਇਸ ਦੇ ਕਰਨ ਨਾਲ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਜਾਂ ਜਿਹਨਾਂ ਨੂੰ ਨਹੀਂ ਕੋਈ ਹੈ ਤਾਂ ਉਹ ਉਹਨਾਂ ਦਾ ਸਰੀਰ ਅ ਤੰਦਰੁਸਤ ਰਹਿੰਦਾ ਹੈ ਆਟੋਮੈਟਿਕਲੀ